ਭਾਰਤੀ ਕਲਾ ਸ਼ੈਲੀਆਂ ਦੇ ਵਿੱਚ ਹਨ ਜਿਵੇਂ ਪੇਂਟਿੰਗ ਮੂਰਤੀ ਮਿੱਟੀ ਦੇ ਬਰਤਨ ਬਣਾਉਣੇ ਅਤੇ ਰੇਸ਼ਮ ਦੇ ਬੁਣੇ ਹੋਏ ਕੱਪੜੇ ਵਰਗੀਆਂ ਆਦਿ ਕਲਾਵਾਂ ਸ਼ਾਮਿਲ ਹਨ ਜਿਹੜੀਆਂ ਅੱਜ ਕੱਲ੍ਹ ਅਲੋਪ ਹੁੰਦੀਆਂ ਜਾ ਰਹੀਆਂ ਹਨ ਅਤੇ ਅੱਜ ਕੱਲ੍ਹ ਸਾਇੰਸ ਦੇ ਯੁੱਗ ਦੇ ਕਾਰਨ ਮਸ਼ੀਨਾਂ ਰਾਹੀਂ ਜੋ ਬਰਤਨ ਤਿਆਰ ਹੁੰਦੇ ਹਨ ਅਤੇ ਮੂਰਤੀਆਂ ਬਣਾਈਆਂ ਜਾਂਦੀਆਂ ਹਨ ਅਤੇ ਕੱਪੜੇ ਦੀਆਂ ਬਹੁਤ ਸਾਰੀਆਂ ਭਿੰਨ ਭਿੰਨ ਪ੍ਰਕਾਰ ਦੀਆਂ ਕਿਸਮਾਂ ਆ ਰਹੀਆਂ ਹਨ ਇਹਨਾਂ ਨੂੰ ਇਹਨਾਂ ਦੇ ਅਲੋਪ ਹੋਣ ਦੀ ਦਿਸ਼ਾ ਨੂੰ ਘਟਾਇਆ ਜਾਂ ਘਟਾਉ ਘਟਾਉਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ ਕਿਉਂਕਿ ਇਹਨਾਂ ਨੂੰ ਇਹਨਾਂ ਦੀ ਸੰਭਾਲ ਦੇ ਨਾਲ ਹੀ ਜੋ ਸਾਡਾ ਪੁਰਾਤਨ ਸੱਭਿਆਚਾਰ ਹੈ ਉਹ ਅਸੀਂ ਸੰਭਾਲ ਸਕਾਂਗੇ ਅਤੇ ਆਧੁਨਿਕ ਸਮੇਂ ਦੇ ਰਸਤੇ 'ਤੇ ਭਾਰਤੀ ਕਲਾ ਅਤੇ ਸੱਭਿਆਚਾਰ ਪ੍ਰਭਾਵਾਂ ਦੇ ਨਾਲ ਸਾਡੇ ਹਿੰਦੂ ਧਰਮ ਬੁੱਧ ਧਰਮ ਜੈਨ ਧਰਮ ਸਿੱਖ ਧਰਮ ਅਤੇ ਇਸਲਾਮ ਵਰਗੇ ਧਾਰਮਿਕ ਪ੍ਰਭਾਵ ਵੀ ਇਹਨਾਂ ਉੱਪਰ ਪਏ ਹਨ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ ਇਹਨਾਂ ਦੇ ਨਾਲ ਅਸੀਂ ਆਪਣੇ ਪੁਰਾਣੇ ਸੱਭਿਆਚਾਰਾਂ ਦੇ ਨਾਲ ਜੁੜੇ ਰਹਿੰਦੇ ਹਾਂ ਅਤੇ ਆਪਣੇ ਰੀਤੀ ਰਿਵਾਜ਼ ਨੂੰ ਹਮੇਸ਼ਾ ਸੰਭਾਲ ਕੇ ਰੱਖ ਸਕਦੇ ਹਾਂ